ਪੰਜ ਸਤੰਬਰ ਦੋ ਹਜ਼ਾਰ ਦੋ ਇੱਕੀ ਅਕਤੂਬਰ ਦੋ ਹਜ਼ਾਰ ਚਾਰ ਇੱਕ ਜੂਨ ਦੋ ਹਜ਼ਾਰ ਦਸ ਇਕੱਤੀ ਦਸੰਬਰ ਉੱਨੀ ਸੌ ਪਚਾਨਵੇਂ ਤੀਹ ਮਈ ਦੋ ਹਜ਼ਾਰ ਤੇਈ